ਹਾਂਜੀ ਬਿਲਕੁਲ ਮੈਂ ਸਾਰਿਆਂ ਨਾਲ ਇਕੱਠੇ ਖਾਣਾ ਖਾਣ ਦਾ ਆਨੰਦ ਮਾਣਦੀ ਹਾਂ ਪੰਜਾਬੀਆਂ ਦੀ ਤਾਂ ਪਰੰਪਰਾ ਹੀ ਹੈ ਇਕੱਠੇ ਬਹਿ ਕੇ ਖਾਣਾ ਖਾਣਾ ਇਹ ਸਿਰਫ ਇਕੱਠੇ ਬਹਿ ਕੇ ਖਾਣਾ ਖਾਣਾ ਹੀ ਨਹੀਂ ਹੈ ਪਰਿਵਾਰ ਇਕੱਠੇ ਬਹਿ ਕੇ ਆਪਸ ਵਿੱਚ ਦੁੱਖ ਸੁੱਖ ਫਰੋਲ ਲੈਂਦਾ ਹੈ ਬੱਚੇ ਆਪਣੇ ਮਾਂ ਬਾਪ ਨੂੰ ਦੱਸ ਦਿੰਦੇ ਹਨ ਕਿ ਉਹਨਾਂ ਨੇ ਅੱਜ ਕੀ ਕੀ ਕੀਤਾ ਸਾਰੇ ਦਿਨ 'ਚ ਉਹਨਾਂ ਦਾ ਦਿਨ ਕਿਵੇਂ ਗਿਆ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਦੱਸਦੇ ਹਨ ਕਿ ਅੱਜ ਅਸੀਂ ਆਹ ਕੀਤਾ ਕੀਤਾ ਜਾਂ ਜੋ ਵੀ ਹੁੰਦਾ ਹੈ ਇਹਦੇ ਨਾਲ ਫੈਮਿਲੀ ਦਾ ਆਪਸ ਵਿੱਚ ਪਿਆਰ ਮੇਲ ਮਿਲਾਪ ਵੱਧਦਾ ਹੈ ਇੱਕ ਦੂਜੇ ਨੂੰ ਜਾਨਣ ਦਾ ਮੌਕਾ ਮਿਲਦਾ ਹੈ ਰਿਸ਼ਤਿਆਂ 'ਚ ਜ਼ਿਆਦਾ ਪਿਆਰ ਵੱਧਦਾ ਹੈ ਰਿਸ਼ਤੇ ਜ਼ਿਆਦਾ ਅੱਛੀ ਤਰ੍ਹਾਂ ਨਿਭਦੇ ਹਨ ਬੜੇ ਮੌਕੇ ਹੁੰਦੇ ਹਨ ਜਿੱਥੇ ਆਪਾਂ ਲੋਕਾਂ ਨੂੰ ਆਸ ਪੜੋਸ ਨੂੰ ਰਿਸ਼ਤੇਦਾਰਾਂ ਨੂੰ ਲੰਚ ਡਿਨਰ ਦਾ ਸੱਦਾ ਦੇ ਸਕਦੇ ਹਾਂ ਜਿੱਦਾਂ ਕਿ ਕਿਸੇ ਦਾ ਘਰ ਵਿੱਚ ਜਨਮਦਿਨ ਆ ਗਿਆ ਜਾਂ ਕੋਈ ਧਾਰਮਿਕ ਲੰਚ ਹੋ ਗਿਆ ਜਾਂ ਕਿਸੇ ਦਾ ਵਿਆਹ ਸ਼ਾਦੀ ਜਾਂ ਫਿਰ ਕੋਈ ਮੰਦਿਰ ਗੁਰਦੁਆਰੇ ਵਿੱਚ ਕੋਈ ਸਮਾਗਮ ਜਾਂ ਫਿਰ ਦਾਵਤ ਜਾਂ ਫਿਰ ਉੱਦਾਂ ਹੀ ਇਕੱਠੇ ਬਹਿਣਾ ਫੈਮਿਲੀ ਦਾ ਗੈਟ ਟੂਗੈਦਰ ਆਪਾਂ ਹੋਰ ਵੀ ਕਾਫੀ ਜਗ੍ਹਾ 'ਤੇ